ਸਾਡੇ ਭਾਰਤ ਵਿੱਚ ਬਹੁਤ ਕਿਸਮ ਦੀਆਂ ਕਲਾ ਸ਼ੈਲੀਆਂ ਉਪਲਬਧ ਸਨ ਬਟ ਜਿਵੇਂ ਜਿਵੇਂ ਸਮਾਂ ਬੀਤਦਾ ਜਾ ਰਿਹਾ ਹੈ ਇਹ ਪੁਰਾਤਨ ਕਲਾ ਸ਼ੈਲੀਆਂ ਅਲੋਪ ਹੋ ਰਹੀਆਂ ਹਨ ਅਲੋਪ ਹੋਣ ਦਾ ਕਾਰਨ ਜੋ ਹੈ ਉਹ ਹੈ ਕਿ ਅੱਜ ਕੱਲ੍ਹ ਦਾ ਜਿਹੜਾ ਛੋਟੇ ਬੱਚੇ ਕਹਿ ਲਉ ਜਾਂ ਜਿਹੜੇ ਅੱਜ ਕੱਲ੍ਹ ਦੇ ਯੁਵਾ ਕਹਿ ਲਉ ਉਹਨਾਂ ਵਿੱਚ ਉਹ ਕਰੇਜ਼ ਖਤਮ ਹੋ ਰਿਹਾ ਉਹ ਆਪਣੇ ਕਲਚਰ ਤੋਂ ਆਪਣੇ ਸੱਭਿਆਚਾਰ ਤੋਂ ਦੂਰ ਜਾ ਰਹੇ ਹਨ ਜਿਵੇਂ ਅਸੀਂ ਇੱਕ ਉਦਾਹਰਨ ਦੇ ਤੌਰ 'ਤੇ ਪੰਜਾਬੀਆਂ ਦੀ ਗੱਲ ਕਰੀਏ ਤਾਂ ਪੰਜਾਬੀ ਆਪਣੇ ਪੁਰਾਤਨ ਸਮੇਂ ਦੇ ਵਿੱਚ ਆਪਣੇ ਪਹਿਰਾਵੇ ਦੇ ਨਾਲ ਆਪਣੀ ਬੋਲ ਚਾਲ ਦੇ ਵਜੋਂ ਜਾਣੇ ਜਾਂਦੇ ਸਨ ਉਹਨਾਂ ਦਾ ਭਾਵੇਂ ਘਰਾਂ ਦੇ ਵਿੱਚ ਕੋਈ ਵੀ ਵਿਆਹ ਹੋਵੇ ਕੋਈ ਸਮਾਗਮ ਹੋਵੇ ਆਦਮੀਆਂ ਨੇ ਕੀ ਆਪਣੇ ਕੁੜਤਾ ਪਜਾਮਾ ਪਾਉਂਦੇ ਹੁੰਦੇ ਸਨ ਮੁਟਿਆਰਾਂ ਸੂਟ ਪਾਉਂਦੀਆਂ ਸਨ ਉੱਤੇ ਫੁਲਕਾਰੀ ਦੇ ਦੁਪੱਟੇ ਲੈਂਦੀਆਂ ਸਨ ਇਹ ਫੁਲਕਾਰੀ ਦੇ ਦੁਪੱਟੇ ਜਿਹੜੇ ਇਹ ਅੱਜ ਕੱਲ੍ਹ ਹੁਣ ਸਿਰਫ ਸਮਾਗਮਾਂ ਵਿੱਚ ਕਿਸੇ ਨੂੰ ਹਾਰ ਸ਼ਿੰਗਾਰ ਦਾ ਕਾਰਨ ਹੀ ਸਮਝੇ ਜਾਂਦੇ ਹਨ ਉਹ ਅੱਜ ਕੱਲ੍ਹ ਆਮ ਤੌਰ 'ਤੇ ਨਹੀਂ ਲਏ ਜਾਂਦੇ ਇਹ ਉਹ ਕਲਾ ਹੈ ਜਿੰਨੇ ਪਿਛਲੇ ਸਮੇਂ ਦੇ ਵਿੱਚ ਪੁਰਾਤਨ ਸਮੇਂ ਦੇ ਵਿੱਚ ਪੰਜਾਬੀਆਂ ਦਾ ਇੱਕ ਆਮਦਨ ਦਾ ਸਾਧਨ ਵੀ ਮੰਨਿਆਂ ਜਾਂਦਾ ਸੀ ਹੁਣ ਇਹ ਫੁਲਕਾਰੀ ਜਿਹੜੀ ਹੈ ਇਹ ਘਰਾਂ ਦਾ ਸਿਰਫ ਇੱਕ ਸ਼ਿੰਗਾਰ ਬਣ ਗਈ ਹੈ ਪਹਿਲਾਂ ਕੀ ਹੁੰਦਾ ਸੀ ਕਿ ਕਿਸੇ ਮੁਟਿਆਰ ਦਾ ਵਿਆਹ ਜਦੋਂ ਧਰਿਆ ਜਾਂਦਾ ਸੀ ਉਹ ਆਪਣੀ ਸਹੇਲੀਆਂ ਨਾਲ ਭਰਜਾਈਆਂ ਦੇ ਨਾਲ ਮਿਲ ਕੇ ਇਹ ਇਹ ਸਾਰੀਆਂ ਫੁਲਕਾਰੀਆਂ ਦੀ ਕੱਢ ਆਪਣੇ ਘਰ ਦੇ ਵਿੱਚ ਹੀ ਕਰਦੇ ਸਨ ਜਿਹੜੀਆਂ ਬੈੱਡਸ਼ੀਟਾਂ ਸੀ ਓਹਨਾਂ ਦੀ ਵੀ ਓਨਾਂ ਉੱਪਰ ਵੀ ਮੀਨਾਕਾਰੀ ਉਹ ਆਪ ਹੀ ਆਪਣੇ ਹੱਥਾਂ ਨਾਲ ਕਰਦੀਆਂ ਸਨ ਜਿਵੇਂ ਸਫੈਦ ਕੁੜਤਾ ਚਾਦਰਾ ਜਿਹਨੂੰ ਅਸੀਂ ਕਹਿੰਦੇ ਹਾਂ ਉਹ ਹੁਣ ਸਭ ਖਤਮ ਹੋ ਰਹੇ ਹਨ ਉਹਦੀਆਂ ਦੀ ਜਗ੍ਹਾ 'ਤੇ ਨਵੀਨੀਕਰਨ ਕਹਿ ਲਉ ਜਿਹੜੇ ਅੱਜ ਕੱਲ੍ਹ ਜੀਨਾਂ ਹੋਗੀਆਂ ਉਹਨਾਂ ਦੇ ਨਾਲ ਟੋਪ ਉਹ ਪਾਉਣਾ ਸ਼ੁਰੂ ਹੋ ਗਏ ਹਨ ਇਹਦੇ ਨਾਲ ਨਾਲ ਜਿਵੇਂ ਪੁਰਾਣੇ ਜ਼ਮਾਨੇ ਵਿੱਚ ਪਾਪੜ ਵੜੀਆਂ ਘਰਾਂ ਵਿੱਚ ਬਣਦੇ ਸਨ ਹੁਣ ਜਿਹੜੇ ਲੋਕ ਵਿਦੇਸ਼ਾਂ ਤੋਂ ਆਉਂਦੇ ਹਨ ਉਹ ਲੱਭਦੇ ਨੇ ਦੁਕਾਨਾਂ ਤੋਂ ਜਾ ਕੇ ਇਹ ਸਾਰੀਆਂ ਹਸਤ ਕਲਾਵਾਂ ਨੇ ਜਿਹੜੀਆਂ ਕਿ ਹੁਣ ਨਵੀਨੀਕਰਨ ਦੇ ਬੋਝ ਥੱਲੇ ਆ ਕੇ ਖਤਮ ਹੋ ਰਹੀਆਂ ਹਨ